ਸਤਿ ਸ਼੍ਰੀ ਅਕਾਲ ਕੀ ਮੈਂ ਸਵੀਗੀ ਕਸਟਮਰ ਕੇਅਰ 'ਤੇ ਗੱਲ ਕਰ ਰਹੀ ਹਾਂ ਮੈਂ ਰਾਜ ਭੰਡਾਰੀ ਮੁਹੱਲੇ ਦੀ ਨਿਵਾਸੀ ਹਾਉਸ ਨੰਬਰ ਦੋ ਸੌ ਚਾਲੀ ਨੀਅਰ ਭਾਗੇ ਬੇਕਰੀ ਤੋਂ ਗੱਲ ਕਰ ਰਹੀ ਹਾਂ ਮੈਂ ਪਲਕ ਰੈਸਟੋਰੈਂਟ ਤੋਂ ਅੱਜ ਦੋ ਪੀਜ਼ਾ ਦੋ ਬਰਗਰ ਦਾ ਆਰਡਰ ਕੀਤਾ ਸੀ ਜੋ ਕਿ ਅਸੀਂ ਇੱਕ ਘੰਟੇ ਦੀ ਵੇਟਿੰਗ ਤੋਂ ਬਾਅਦ ਵੀ ਸਾਡੇ ਕੋਲ ਨਹੀਂ ਪੁੱਜਾ ਜਿਸ ਕਰਕੇ ਮੈਂ ਆਪਣਾ ਆਰਡਰ ਕੈਂਸਲ ਕਰਨਾ ਚਾਹੁੰਦੀ ਹਾਂ ਅਤੇ ਮੈਨ ਮੈਂ ਚਾਹੁੰਦੀ ਹਾਂ ਕਿ ਮੇਰਾ ਜੋ ਪੇਮੈਂਟ ਮੈਂ ਪਹਿਲਾਂ ਕੀਤੀ ਸੀ ਉਹ ਮੈਨੂੰ ਰਿਫੰਡ ਕੀਤੀ ਜਾਵੇ ਆਪ ਜੀ ਦੀ ਧੰਨਵਾਦ